ਓ ਕਾਦੇ ਹਾਲ ਸਰਕਾਰਾਂ ਨੇ ਨਾ ਸਾਡੇ ਕਿਸਾਨਾਂ ਨੂੰ ਖਤਮ ਹੀ ਕਰ ਦਿੱਤਾ ਉਹ ਕਦੇ ਭਰਾ ਕੁਦਰਤੀ ਆਫਤਾਂ ਉਹ ਕੀ ਕਹਿੰਦੇ ਜਿਹੜੇ ਗਲੋਬਲ ਵਾਰਮਿੰਗ ਉਹ ਆਹੋ ਕੋਈ ਖੇਤੀਬਾੜੀ ਨੂੰ ਬੜਾ ਪ੍ਰਭਾਵਿਤ ਕਰੀ ਜਾਂਦੇ ਨੇ ਉਹ ਕਦੀ ਗਰਮੀ ਆ ਜਾਂਦੀ ਉਹ ਅਤੇ ਜਦੋਂ ਲਗਾਉਂਦੇ ਹਾਂ ਅਸੀਂ ਆ ਕੀ ਆਉਂਦੇ ਆ ਸਾਡੀ ਕਣਕ ਲਗਾਉਂਦੇ ਹਾਂ ਅਸੀਂ ਉਹ ਤੋਂ ਪਹਿਲਾਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਫਿਰ ਉਹ ਸਾਰੀ ਆਹ ਅਤੇ ਕਣਕਾਂ ਹੋ ਜਾਂਦੀਆਂ ਸਾਰੀਆਂ ਮੁੱਧੀਆਂ ਪੈ ਜਾਂਦੀਆਂ ਅਤੇ ਫਿਰ ਜਦੋਂ ਕਿਧਰੇ ਮੁੜ ਕੇ ਜਦੋਂ ਲੋੜ ਹੁੰਦੀ ਪਾਣੀ ਦੀ ਜਦੋਂ ਆਪਾਂ ਝੋਨੇ ਲਗਾਉਣੇ ਹੁੰਦੇ ਝੋਨਿਆਂ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਪਾਣੀ ਹੀ ਨਹੀਂ ਪਾਣੀ ਮਿਲਦਾ ਨਹੀਂ ਆ ਅਤੇ ਬਾਅਦ ਚੋਂ ਜਦੋਂ ਪੱਕਣ 'ਤੇ ਆਉਂਦੀ ਹੈ ਉਦੋਂ ਹੜ੍ਹ ਆ ਜਾਂਦੇ ਆ ਅਤੇ ਮੁੜ ਕੇ ਫਿਰ ਕ ਫਸਲਾਂ ਸਾਰੀਆਂ ਤਬਾਹ ਹੋ ਜਾਂਦੀਆਂ ਨੇ ਮੁੜ ਕੇ ਨਾ ਅਤੇ ਕਿਸਾਨ ਸਾਨੂੰ ਤਾਂ ਦੁਖੀ ਕੀਤਾ ਪਿਆ ਸਰਕਾਰਾਂ ਨੇ ਆਹ ਦਿੰਦੇ ਹਾਂ ਆਹ ਦਿੰਦੇ ਹਾਂ ਤੁਹਾਨੂੰ ਕਦੀ ਆ ਮੁਆਵਜੇ ਮਿਲਣੇ ਆ ਮੁਆਵਜੇ ਕਾਹਦੇ ਮਿਲਦੇ ਸਾਨੂੰ ਅਸੀਂ ਤਾਂ ਕਰਜੇ ਥੱਲੇ ਦੱਬ ਜਾਂਦੇ ਹਾਂ ਅਤੇ ਹਾਂ ਤਾਂ ਕੀ ਕਰੀਏ ਸਰਕਾਰਾਂ ਨੂੰ ਬੜਾ ਦੁਖੀ ਕੀਤਾ ਪਿਆ ਇਹਨਾਂ ਨੇ ਹੋਰ ਹੋਰ ਭਰਾ ਕੀ ਹਾਲ ਚਾਲ ਨੇ ਘਰ ਦੇ ਬਾਕੀ ਚੱਲ ਆਹ ਚਲੀਏ ਆਪਣੇ ਆਪਣੇ ਘਰਾਂ ਨੂੰ ਹੁਣ ਚਲੀਏ ਘਰ ਜਾ ਕੇ ਥੋੜ੍ਹਾ ਬਹੁਤ ਕਿਧਰੇ ਅਰਾਮ ਕਰੀਏ ਥੱਕ ਜਾਈਦਾ ਸਾਰਾ ਦਿਨ ਕੰਮ ਕਰਕੇ ਓ ਛੱਡ ਚੱਲ ਓਕੇ